ਵੈਸੇ ਤਾਂ ਭਾਰਤ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਸਥਾਨ ਹੈ ਪਰ ਆਪਾਂ ਇੱਥੇ ਕੁੱਝ ਖਾਸ ਜਿਹੜੇ ਹੈਗੇ ਹੈ ਕੁੱਝ ਕੁ ਉਹਨਾਂ ਦਾ ਹੀ ਜ਼ਿਕਰ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਜਿਹਨੂੰ ਕਿ ਗੋਲਡਨ ਟੈਂਪਲ ਦੇ ਨਾਮ ਤੋਂ ਜਾਣਦੇ ਆ ਠੀਕ ਹੈ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਕੀ ਹੈ ਜੀ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਵੀ ਜਿਹੜੀਆਂ ਸੰਗਤਾਂ ਹੈ ਉਹ ਇੱਥੇ ਦਰਸ਼ਨ ਕਰਨ ਆਉਂਦੀਆਂ ਹੈ ਇਹਨਾਂ ਨੂੰ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਜਿਹੜੇ ਸਿੱਖਾਂ ਦੇ ਗੁਰੂ ਹੈ ਚੌਥੇ ਉਨ੍ਹਾਂ ਨੇ ਇਹਦਾਂ ਕੀ ਸੀਗਾ ਕੀ ਅ ਸਟਾਟ ਕੀਤਾ ਸੀਗਾ ਸ਼ੁਰੂਆਤ ਕੀਤੀ ਸੀ ਅਤੇ ਜਿਹੜਾ ਸਰੋਵਰ ਦੀ ਤਿਆਰੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸੋਭਿਤ ਕੀਤੇ ਗਏ ਉਹ ਸਿੱਖਾਂ ਦੇ ਜਿਹੜੇ ਪੰਜਵ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸੀਗੇ ਉਹਨਾਂ ਨੇ ਕੀਤੇ ਸੀਗੇ ਅਤੇ ਠੀਕ ਹੈ ਅੱਜ ਵੀ ਅਗਰ ਤੁਸੀਂ ਟੀ ਵੀ ਵਿੱਚ ਦੇਖ ਸਕਦੇ ਹੋ ਲਾਈਵ ਟੈਲੀਕਾਸਟ ਆਉਂਦਾ ਪੀ ਟੀ ਸੀ ਨਿਊਜ਼ ਤੋਂ ਸ਼੍ਰੀ ਦਰਬਾਰ ਸਾਹਿਬ ਦਾ ਉੱਥੋ ਤੁਹਾਨੂੰ ਪਤਾ ਲੱਗਜੇਗਾ ਕਿ ਦੇਸ਼ ਵਿਦੇਸ਼ ਤੋਂ ਵੀ ਜਿਹੜੀਆਂ ਕਿੰਨੀਆਂ ਸੰਗਤਾਂ ਹੈ ਇੱਥੇ ਆ ਕੇ ਨਮਸਤਕ ਹੁੰਦੀਆਂ ਹੈ ਇਹ ਜਿਹੜਾ ਸਥਾਨ ਹੈ ਇਹ ਪੰਜਾਬ ਦਾ ਜਿਹੜਾ ਜ਼ਿਲ੍ਹਾ ਹੈ ਅੰਮ੍ਰਿਤਸਰ ਉੱਥੇ ਇਹ ਸ਼ੁਸ਼ੋਭਿਤ ਹੈ ਸ਼੍ਰੀ ਹਰਿਮੰਦਰ ਸਾਹਿਬ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਭਾਰਤ ਦੀ ਜਿਹੜੀ ਰਾਜਧਾਨੀ ਆ ਜੀ ਉੱਥੇ ਪਹੁੰਚਦੇ ਆ ਦਿੱਲੀ ਦਿੱਲੀ ਵਿੱਚ ਅਸੀਂ ਗੱਲ ਕਰਦੇ ਆ ਇੰਡੀਆ ਗੇਟ ਦੀ ਇੰਡੀਆ ਗੇਟ ਬਾਰੇ ਜਿਹੜਾ ਵੀ ਕੋਈ ਸ਼ਖਸੀਅਤ ਦਿੱਲੀ ਜਾਂਦੀ ਹੋਊਂਗੀ ਉਹ ਇੰਡੀਆ ਗੇਟ ਜ਼ਰੂਰ ਜਾਂਦੀ ਹੋਊਂਗੀ ਠੀਕ ਹੈ ਜੀ ਅਤੇ ਜਿਹੜਾ ਰਾਤ ਦਾ ਦ੍ਰਿਸ਼ ਹੈ ਇੰਡੀਆ ਗੇਟ ਦਾ ਉਹ ਬਹੁਤ ਹੀ ਸੁਹਾਵਣਾ ਹੁੰਦਾ ਹੈ ਤੁਸੀਂ ਉੱਥੇ ਜਦੋਂ ਵੀ ਜਾਓ ਤਾਂ ਦੇਖ ਸਕਦੇ ਹੋ ਉੱਥੇ ਬੜਾ ਦਿਲ ਲੱਗਦਾ ਹੈ ਉਸ ਤੋਂ ਬਾਅਦ ਤੀਜੀ ਜਿਹੜੀ ਆਪਾਂ ਜ਼ਿਕਰ ਕਰਦੇ ਆ ਉਹ ਆਪਾਂ ਕਰਦੇ ਆ ਜੀ ਲਾਲ ਕਿਲ੍ਹੇ ਦਾ ਇਹ ਵੀ ਕੀ ਹੈ ਦਿੱਲੀ ਵਿੱਖੇ ਹੀ ਹੈ ਜਿਹਨੂੰ ਵੀ ਆਪਾਂ ਰੈੱਡ ਫੋਰਟ ਦੇ ਨਾਮ ਨਾਲ ਵੀ ਜਾਣਦੇ ਆ